ਤੇਈ ਅਗਸਤ ਦੋ ਹਜ਼ਾਰ ਇੱਕ ਅਠਾਈ ਜੁਲਾਈ ਦੋ ਹਜ਼ਾਰ ਚਾਰ ਅਠਾਰਾਂ ਮਈ ਦੋ ਹਜ਼ਾਰ ਛੇ ਉੱਨੀ ਜੁਲਾਈ ਦੋ ਹਜ਼ਾਰ ਸੱਤ ਪੰਜ ਮਾਰਚ ਦੋ ਹਜ਼ਾਰ ਨੌਂ